ਹੈਲੋ ਤੁਸੀਂ ਮੀਸ਼ੂ ਤੋਂ ਬੋਲ ਰਹੇ ਹੋ ਮੈਂ ਗੀਤਾ ਬੋਲ ਰਹੀ ਹਾਂ ਪਿਛਲੇ ਹਫ਼ਤੇ ਮੈਂ ਲੋਹੜੀ ਦੇ ਮੌਕੇ 'ਤੇ ਇੱਕ ਔਫਰ ਦੇਖੀ ਸੀ ਮੇਕਅਪ ਕਿੱਟ ਦੀ ਚਾਰ ਲਿਪਸਟਿਕਾਂ ਦੀ ਪੈਕਿੰਗ ਸੀਗੀ ਉਹ ਮੈਨੂੰ ਵੇਖ ਕੇ ਜੇ ਪਸੰਦ ਆਇਆ ਅਤੇ ਮੈਂ ਕਿਹਾ ਚਲੋ ਇੱਕ ਮੈਂ ਆਪਣੇ ਵਾਸਤੇ ਲੈਂਦੀ ਹਾਂ ਇੱਕ ਮੈਂ ਆਪਣੀ ਫਰੈਂਡ ਵਾਸਤੇ ਲੈ ਲੈਂਦੀ ਹਾਂ ਔਡਰ ਕਰਵਾ ਲਿਆ ਔਡਰ ਕਰਕੇ ਮੈਨੂੰ ਡਿਲੀਵਰੀ ਬੋਆਏ ਨੇ ਟਾਈਮ 'ਤੇ ਡਿਲੀਵਰੀ ਨਹੀਂ ਕੀਤੀ ਅਤੇ ਜਦੋਂ ਮੇਰੇ ਕੋਲ ਪ੍ਰੋਡੈਕਟ ਘਰ ਆਇਆ ਅਤੇ ਪ੍ਰੋਡਕਟ ਮੈਂ ਦੇਖਿਆ ਕਿ ਉਹਦੇ ਵਿੱਚ ਮੈਨੂੰ ਪੈਕਿੰਗ ਨਹੀਂ ਅੱਛੀ ਲੱਗੀ ਉਸ ਤੋਂ ਬਾਅਦ ਲਿਪਸਟਿਕਾਂ ਜਦੋਂ ਕੱਢੀਆਂ ਤਾਂ ਉਹ ਵੀ ਥੋੜ੍ਹੀਆਂ ਖ਼ਰਾਬ ਜਿਸ ਤਰ੍ਹਾਂ ਕਿ ਸੁੱਕੀਆਂ ਸੁੱਕੀਆਂ ਪੁਰਾਣੀਆਂ ਚੀਜ਼ਾਂ ਜਿਵੇਂ ਪਈਆਂ ਹੁੰਦੀਆਂ ਨਾ ਉਸ ਤਰ੍ਹਾਂ ਦੀ ਹਾਲਤ ਵਿੱਚ ਸੀਗੀਆਂ ਜਦੋਂ ਮੈਂ ਉਸ ਨੂੰ ਖੋਲ ਕੇ ਦੇਖਿਆ ਤਾਂ ਮੇਰਾ ਮੂਡ ਬਹੁਤ ਖ਼ਰਾਬ ਹੋਇਆ ਠੀਕ ਹੈ ਮੇਰਾ ਮੂਡ ਬਹੁਤ ਖ਼ਰਾਬ ਹੋਇਆ ਪੈਕਿੰਗ ਬੁਰੀ ਹਾਲਤ ਵਿੱਚ ਹੋਈ ਹੋਈ ਸੀ ਅਤੇ ਜਿਵੇਂ ਕਿ ਮੈਂ ਇਹਨਾਂ ਗੱਲਾਂ ਕਰਨ ਦਾ ਮੇਰਾ ਮਕਸਦ ਇਹ ਹੈ ਕਿ ਮੈਂ ਉਸ ਔਡਰ ਨੂੰ ਵਾਪਸ ਕਰਨ ਦਾ ਬਾਅਦ ਚੋਂ ਸੋਚਿਆ ਕਿ ਚਲੋ ਮੈਂ ਔਡਰ ਕੰਪਲੇਂਟ ਕਰਦੀ ਹਾਂ ਕੰਪਲੇਂਟ ਕੀਤੀ ਕੰਪਲੇਂਟ ਦਰਜ ਕਰਨ ਦਾ ਮੈਨੂੰ ਕੋਈ ਵੀ ਰਿਸਪੋਂਸ ਨਹੀਂ ਮਿਲਿਆ ਮੈਂ ਕਸਟਮਰ ਕੇਅਰ 'ਤੇ ਕੋਲ ਵੀ ਕੀਤੀ ਉਹਨਾਂ ਨੇ ਕਿਹਾ ਦੋ ਤਿੰਨ ਦਿਨ ਵਿੱਚ ਤੁਹਾਡਾ ਪ੍ਰੋਡਕਟ ਚੇਂਜ ਹੋ ਜਾਵੇਗਾ ਪਰ ਨਹੀਂ ਹੋਇਆ ਇਸਦਾ ਮੈਨੂੰ ਕੋਈ ਲਾਭ ਹੀ ਨਹੀਂ ਮਿਲਿਆ ਮੇਰਾ ਇਹ ਸ਼ੋਪਿੰਗ ਕਰਨ ਦਾ ਇਸ ਵਾਰ ਬਹੁਤ ਬੁਰਾ ਐਕਸਪੀਰੀਅੰਸ ਰਿਹਾ ਵੀ ਇਹ ਸ਼ੋਪਿੰਗ ਮੈਨੂੰ ਕਰਨ 'ਚ ਦਿਲਚਸਪੀ ਜਿਹੀ ਨਹੀਂ ਆਈ ਠੀਕ ਹੈ ਮੇਰੀ ਰਿਕੁਐਸਟ ਹੈ ਤੁਹਾਡੇ ਅੱਗੇ ਕਿ ਕਿ ਆਫਟਰ ਸੇਲਸ ਸਰਵਿਸ ਬਿਹਤਰ ਕਰੋ ਕਿ ਤਾਂ ਕਿ ਅਗਾਂਹ ਵਾਸਤੇ ਕੋਈ ਕਸਟਮਰ ਜਿਵੇਂ ਕਿ ਮੇਰੇ ਵਰਗਾ ਕੋਈ ਔਡਰ ਕਰਦਾ ਹੈ ਤਾਂ ਉਹਨੂੰ ਐਂ ਚੀਜ਼ ਤੋਂ ਠੇਸ ਨਾ ਪਹੁੰਚੇ ਥੈਂਕ ਯੂ ਧੰਨਵਾਦ ਤੁਹਾਡਾ ਜੀ